ਸਾਡੇ ਇਤਿਹਾਸ ਵਿੱਚ ਜਦੋਂ ਉੱਨੀ ਸੌ ਚੁਰਾਸੀ ਦੇ ਦੰਗੇ ਹੋਏ ਉਦੋਂ ਲੋਕਾਂ ਨੇ ਇੱਕ ਦੂਜੇ ਦੀ ਮਦਦ ਕੀਤੀ ਉੱਨੀ ਸੌ ਸੰਨਤਾਲੀ ਵੇਲੇ ਵੀ ਜਦੋਂ ਭਾਰਤ ਆਜ਼ਾਦ ਹੋਇਆ ਲੋਕਾਂ ਨੇ ਇੱਕ ਦੂਜੇ ਦੀ ਮਦਦ ਕੀਤੀ ਇੱਕ ਦੂਜੇ ਦੀ ਸਹਾਇਤਾ ਨਾਲ ਹਿੰਦੂ ਮੁਸਲਮਾਨ ਕੋਈ ਵੀ ਜਦੋਂ ਵੀ ਲੜਾਈ ਝਗੜਾ ਹੁੰਦਾ ਸੀਗਾ ਇੱਕ ਦੂਜੇ ਦਾ ਸਾਥ ਦਿੰਦੇ ਸਨ ਅੱਜ ਕੱਲ ਵੀ ਹਿੰਦੂ ਮੁਸਲਮਾਨ ਰਲ ਮਿਲ ਕੇ ਜਦੋਂ ਵੀ ਹਿੰਦੂਆਂ ਸਿੱਖਾਂ ਦਾ ਨਗਰ ਕੀਰਤਨ ਹੁੰਦਾ ਤਾਂ ਉਹਦੇ ਵਿੱਚ ਸ਼ਾਮਿਲ ਹੁੰਦੇ ਆ ਹਿੰਦੂ ਮੁਸਲਮਾਨਾਂ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਆ ਅਤੇ ਜਿਹੜੇ ਸਿੱਖ ਹਿੰਦੂ ਦੋਨੇ ਇੱਕ ਦੂਜੇ ਦੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੁੰਦੇ ਆ ਇਸ ਤਰਾਂ ਇਹ ਆਪਸੀ ਭਾਈਚਾਰਾ ਬਣਾ ਕੇ ਰੱਖਦੇ ਆ ਜਦੋਂ ਵੀ ਕਦੇ ਇਹ ਲੜਾਈ ਝਗੜਾ ਹੁੰਦਾ ਇੱਕ ਦੂਜੇ ਦੀ ਸਹਾਇਤਾ ਕਰਦੇ ਆ ਉੱਨੀ ਸੋ ਚੁਰਾਸੀ ਦੇ ਦੰਗਿਆਂ ਵੇਲੇ ਵੀ ਦੋਨਾਂ ਨੇ ਇੱਕ ਦੂਜੇ ਦੀ ਸਹਾਇਤਾ ਕੀਤੀ ਅਤੇ ਦੋਨਾ ਦੋਨੇ ਹਿੰਦੂ ਮੁਸਲਮਾਨ ਸਾਰੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਥ ਦਿੰਦੇ ਆ ਉੱਨੀ ਸੌ ਚੁਰਾਸੀ ਦੇ ਦੰਗਿਆਂ ਵਿੱਚ ਦੋਨਾਂ ਨੇ ਰਲ ਮਿਲ ਕੇ ਉਹਨਾਂ ਦੁਸ਼ਮਣਾਂ ਦਾ ਸਾਹਮਣਾ ਕੀਤਾ ਅਤੇ ਇਦਾਂ ਹੀ ਇਹਨਾਂ ਨੇ ਆਪਸੀ ਭਾਈਚਾਰੇ ਨੂੰ ਬਣਾ ਕੇ ਰੱਖਿਆ